ਜੇਕਰ ਅਸੀਂ ਲੱਟਕਣਦਾਰ ਵਾਲੀਆਂ ਰੋਜ਼ਾਨਾ ਪਾਉਂਦੇ ਹਾਂ ਤਾਂ ਸਾਡੇ ਕੰਨਾਂ ਦੇ ਛੇਦ ਵੱਡੇ ਹੋਣ ਦਾ ਡਰ ਰਹਿੰਦਾ ਹੈ ਜੇਕਰ ਉਹ ਬਾਹਰ ਕਿਤੇ ਉਹ ਇੰਨੇ ਹਲਕੇ ਹੁੰਦੇ ਹਨ ਕਿ ਜੇਕਰ ਕਿਤੇ ਡਿੱਗ ਜਾਣ ਤਾਂ ਪਤਾ ਨਹੀਂ ਲੱਗਦਾ ਇਹਨਾਂ ਨੂੰ ਪਹਿਨਣ ਦੇ ਨਾਲ਼ ਕੋਈ ਐਲਰਜੀ ਹੋ ਸਕਦੀ ਹੈ ਜੇਕਰ ਇਹ ਵਾਲੀਆਂ ਕਿਤੇ ਕੱਪੜਿਆਂ ਦੇ ਵਿੱਚ ਜਾਂ ਵਾਲਾਂ ਵਿੱਚ ਫਸ ਜਾਵੇ ਤਾਂ ਸੱਟ ਲੱਗਣ ਦਾ ਵੀ ਡਰ ਰਹਿੰਦਾ ਹੈ